ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਬਿਲਕੁਲ ਨਿਰਭਰ ਕਰਦੀ ਹੈ ਅਜਿਹਾ ਇਸ ਤਰ੍ਹਾਂ ਹੈ ਕਿਉਂਕਿ ਜਦੋਂ ਅਸੀਂ ਕਦੀ ਕੰਪਿਊਟਰ 'ਤੇ ਅਤੇ ਕੰਮ ਕਰਨ ਬੈਠਦੇ ਹਾਂ ਜੇ ਬੱਤੀ ਪਿੱਛੋਂ ਕੱਟ ਲੱਗਾ ਹੋਵੇ ਤਾਂ ਅਸੀਂ ਆਪਣੇ ਕੰਪਿਊਟਰ 'ਤੇ ਕੰਮ ਨਹੀਂ ਕਰ ਸਕਦੇ ਕਿਉਂਕਿ ਉਹ ਕੰਪਿਊਟਰ ਬੱਤੀ ਤੋਂ ਬਿਨਾਂ ਨਹੀਂ ਚੱਲ ਸਕਦਾ ਸਾਡਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ ਉਸੇ ਤਰ੍ਹਾਂ ਹੀ ਹੋਰ ਵੀ ਰੁਜ਼ਗਾਰ ਹਨ ਜਿੱਦਾਂ ਕਿ ਫੈਕਟਰੀਆਂ ਹਨ ਜਿਹੜੀਆਂ ਕਿ ਬੱਤੀ ਤੋਂ ਵਗੈਰ ਨਹੀਂ ਚੱਲ ਪਾਉਂਦੀਆਂ ਜੇ ਉੱਥੇ ਲੰਬੇ ਕੱਟ ਲੱਗ ਜਾਣ ਅਤੇ ਉੱਥੇ ਉਤਪਾਦਨ ਖ਼ਤਮ ਹੋ ਜਾਂਦਾ ਹੈ ਘੱਟ ਜਾਂਦਾ ਹੈ ਅਤੇ ਉਹਨਾਂ ਦੀ ਆਮਦਨੀ 'ਤੇ ਬਹੁਤ ਫ਼ਰਕ ਪੈਂਦਾ ਹੈ ਕਿਉਂਕਿ ਜਿਹੜੇ ਉਹਨਾਂ ਨੇ ਵਰਕਰ ਰੱਖੇ ਹੁੰਦੇ ਹਨ ਉਹਨਾਂ ਨੂੰ ਉਹਨਾਂ ਨੇ ਇਹ ਸੈਲਰੀਆਂ ਦੇਣੀਆਂ ਹੁੰਦੀਆਂ ਹਨ ਪਰ ਜੇ ਉੱਥੇ ਕੱਟ ਲੰਬੇ ਲੱਗਣਗੇ ਤਾਂ ਉਹਨਾਂ ਦਾ ਕੰਮ ਵੀ ਘੱਟ ਜਾਂਦਾ ਹੈ ਇਸ ਕਰਕੇ ਪਰ ਅੱਜ ਦੇ ਟਾਈਮ ਵਿੱਚ ਵਿੱਚ ਇਨਵਰਟਰ ਲੋਕਾਂ ਦੇ ਘਰ ਲੱਗੇ ਹਨ ਪਰ ਇਨਵਰਟਰ ਨਾਲ ਜੋ ਬੱਤੀ ਦਾ ਲੋਡ ਹੈ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਬੱਤੀ ਦੇ ਕੱਟ ਜਿੰਨੇ ਘੱਟ ਲੱਗਣਗੇ ਉਨੇ ਹੀ ਬੇਹਤਰ ਹੋਏਗਾ ਧੰਨਵਾਦ ਜੀ